ਮੈਨੂੰ ਸਮਕਾਲੀ ਸੰਗੀਤ ਸੁਣਨਾ ਬਹੁਤ ਪਸੰਦ ਹੈ ਸਮਕਾਲੀ ਸੰਗੀਤ ਨੂੰ ਕੰਟੈਮਪਰੇਰੀ ਸੰਗੀਤ ਵਿੱਚ ਕਿਹਾ ਜਾਂਦਾ ਹੈ ਕੰਟੈਮਪਰੇਰੀ ਮਤਲਬ ਮੋਡਨ ਸੰਗੀਤ ਉਹ ਸੰਗੀਤ ਜੋ ਅੱਜ ਕੱਲ੍ਹ ਦੇ ਸਮੇਂ ਵਿੱਚ ਬਣ ਰਿਹਾ ਹੈ ਅਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਪਸੰਦ ਕਰਦਾ ਹੈ ਸਮਕਾਲੀ ਸੰਗੀਤ ਮੋਡਰਨ ਸੰਗੀਤ ਹੈ ਜਿਵੇਂ ਕਿ ਅੱਜ ਕੱਲ੍ਹ ਜਿਹੜੇ ਪੰਜਾਬੀ ਗਾਣੇ ਜਿਹੜੇ ਅਸੀਂ ਟੀ ਵੀ ਯੂਟੀਊਬ ਅਤੇ ਹੋਰ ਚੈਨਲਾਂ 'ਤੇ ਸੁਣਦੇ ਹਾਂ ਮੈਨੂੰ ਇਹ ਸੰਗੀਤ ਇਸ ਲਈ ਬਹੁਤ ਪਸੰਦ ਹੈ ਕਿਉਂਕਿ ਇਹ ਸਾਡਾ ਮਨ ਨੂੰ ਖੁਸ਼ ਕਰਦੇ ਹਨ ਪੰਜਾਬੀ ਸੰਗੀਤ ਅਤੇ ਪੰਜਾਬੀ ਲੋਕ ਖੁਸ਼ ਹੋ ਕੇ ਭੰਗੜਾ ਅਤੇ ਨੱਚ ਕਰਦੇ ਹਨ ਸਮਕਾਲੀ ਸੰਗੀਤ ਸਭ ਦਾ ਮਨ ਭਾਉਂਦਾ ਹੈ ਸਮਕਾਲੀ ਸੰਗੀਤ ਅਤੇ ਕੁਝ ਫੇਮਸ ਗਾਇਕ ਜਿਵੇਂ ਦਲਜੀਤ ਦੋਸਾਂਝ ਕਰਨ ਔਜਲਾ ਬਿੰਦਰਖੀਆਂ ਮਾਸਟਰ ਸਲੀਮ ਅਤੇ ਹੋਰ ਵੀ ਕਈ ਵਧੀਆ ਸਿੰਗਰ ਨੇ ਇਸ ਸੰਗੀਤ ਨੂੰ ਇੰਟਰਨੈਸ਼ਨਲ ਸਤਰ 'ਤੇ ਪਹੁੰਚਾਇਆ ਪਹੁੰਚਾਇਆ ਹੈ ਜਿਹਨਾਂ ਦੇ ਕੋਨਸਰਟ ਦੇ ਸਾਧਨ ਨਾਲ ਇਸ ਸੰਗੀਤ ਨੂੰ ਪੰਜਾਬ ਤੋਂ ਬਾਹਰ ਪ੍ਰਚਲਿਤ ਕੀਤਾ ਹੈ ਜੇ ਗੱਲ ਕੀਤੀ ਜਾਵੇ ਸ਼ਾਸਤਰੀ ਸੰਗੀਤ ਅਤੇ ਸਮਕਾਲੀ ਸੰਗੀਤ ਨੂੰ ਗਾਉਣ ਦੀ ਸਮਕਾਲੀ ਸੰਗੀਤ ਨੂੰ ਗਾਉਣਾ ਸੌਖਾ ਹੈ ਈ ਮੋਡਰਨ ਮਿਊਜ਼ਿਕ ਅਤੇ ਮੋਡਰਨ ਭਾਵਾਂ ਨੂੰ ਸਰਲਤਾ ਨਾਲ ਪ੍ਰਚਲਿਤ ਕਰਦਾ ਹੈ ਧੰਨਵਾਦ